ਪੱਚੀ ਜਨਵਰੀ ਦੋ ਹਜ਼ਾਰ ਪੰਦਰਾਂ ਗਿਆਰਾਂ ਫਰਵਰੀ ਦੋ ਹਜ਼ਾਰ ਸੌਲਾਂ ਅਠਾਰਾਂ ਮਾਰਚ ਦੋ ਹਜ਼ਾਰ ਅਠਾਰਾਂ ਅਠਾਈ ਫਰਵਰੀ ਦੋ ਹਜ਼ਾਰ ਵੀਹ ਪੰਦਰਾਂ ਅਗਸਤ ਦੋ ਹਜ਼ਾਰ ਇੱਕੀ